ਮੈਨੂੰ ਬਾਈਕਿੰਗ ਸ਼ੁਰੂ ਕਰਨ ਜਾਂ ਉਹਦੀ ਪ੍ਰੇਰਨਾ ਚੀਜ਼ਾਂ ਨੂੰ ਹੋਰ ਵਧੇਰੇ ਵਧੇਰੇ ਤਰੀਕੇ ਨਾਲ ਜਾਣਨ ਅਤੇ ਨਵੀਂ ਨਵੀਂ ਜਗ੍ਹਾਵਾਂ ਨੂੰ ਦੇਖਣਾ ਉਹਨਾਂ ਬਾਰੇ ਪਤਾ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਨੇ ਮੈਨੂੰ ਬਾਈਕਿੰਗ ਲਈ ਵਧੇਰੇ ਪ੍ਰੇਰਿਤ ਕੀਤਾ ਮੈਨੂੰ ਪ੍ਰਕਿਰਤੀ ਨਾਲ ਜੁੜਨ ਦਾ ਪ੍ਰਕਿਰਤੀ ਨਾਲ ਰਹਿਣ ਦਾ ਬੜਾ ਹੀ ਮੈਨੂੰ ਪ੍ਰਕਿਰਤੀ ਨਾਲ ਜੁੜਨ ਨਾਲ ਜੁੜਨ ਨਾਲ ਪ੍ਰਕਿਰਤੀ ਦੇ ਵਿੱਚ ਰਹਿਣ ਨਾਲ ਬਹੁਤ ਹੀ ਵਧੀਆ ਲੱਗਦਾ ਹੈ ਜਿਸ ਦੇ ਵਿੱਚ ਬਾਈਕਿੰਗ ਨੇ ਮੇਰਾ ਬਹੁਤ ਹੀ ਸਾਥ ਦਿੱਤਾ ਮੈਂ ਬਾਈਕਿੰਗ ਨਾਲ ਬਥੇਰੀ ਖੂਬਸੂਰਤ ਪ੍ਰਕਿਰਤਿਕ ਜਗ੍ਹਾਵਾਂ 'ਤੇ ਗਿਆ ਅਤੇ ਉਹਨਾਂ ਜਗ੍ਹਾਵਾਂ ਨੂੰ ਹੋਰ ਵਧੇਰੇ ਤਰੀਕੇ ਨਾਲ ਪਛਾਣ ਦਾ ਮਾਣ ਦਿੱਤਾ ਉਹਨਾਂ ਜਗ੍ਹਾਵਾਂ ਦੇ ਵਿੱਚ ਆਪਣੇ ਆਪ ਨੂੰ ਹੋਰ ਵਧੀਆ ਕੀਤਾ ਆਪਣੇ ਆਪ ਬਾਰੇ ਹੋਰ ਜਾਣਿਆ ਇਹ ਸਾਰੀਆਂ ਚੀਜ਼ਾਂ ਨੇ

ਜਿਵੇਂ ਜਿਵੇਂ ਮੈਂ ਨਵੇਂ ਨਵੇਂ ਜਿਵੇਂ ਜਿਵੇਂ ਮੈਂ ਨਵੇਂ ਨਵੇਂ ਪਲੇਸ ਇਹ ਸਭ 'ਤੇ ਗਿਆ ਜਗ੍ਹਾਵਾਂ 'ਤੇ ਗਿਆ ਮੈਨੂੰ ਓਨਾ ਹੀ ਵਧੀਆ ਮਹਿਸੂਸ ਹੁੰਦਾ ਗਿਆ ਅਤੇ ਮੈਨੂੰ ਹੋਰ ਜਗ੍ਹਾਵਾਂ ਦਾ ਪਤਾ ਲੱਗਦਾ ਗਿਆ ਮੈਨੂੰ ਬਥੇਰੀ ਚੀਜ਼ਾਂ ਦਾ ਪਤਾ ਲੱਗਿਆ ਮੈਨੂੰ ਬਥੇਰੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਬਾਰੇ ਉਹਨਾਂ ਦੀ ਪ੍ਰਥਾ ਉਹਨਾਂ ਦੀ ਪਰੰਪਰਾਵਾਂ ਬਾਰੇ ਜਾਣਨ ਦਾ ਮੌਕਾ ਮਿਲਿਆ ਜਿਸ ਨੇ ਕਿ ਮੇਰੀ ਨੌਲੇਜ ਨੂੰ ਨੌਲੇਜ ਵਿੱਚ ਵਾਧਾ ਕੀਤਾ ਅਤੇ ਮੈਨੂੰ ਇੱਕ ਹੋਰ ਵਧੀਆ ਇਨਸਾਨ ਬਣਨ ਦੇ ਵਿੱਚ ਮਦਦ ਕੀਤੀ